ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਰਾਜਨ ਢਾਬੇ ਤੋਂ ਬੋਲਦੇ ਹੋ ਮੈਂ ਨਾ ਆਪਣੇ ਪੋਤੇ ਦੇ ਜਨਮ ਦਿਨ ਲਈ ਰੋਟੀ ਦਾ ਔਡਰ ਕਰਨਾ ਚਾਹੁੰਦੀ ਹਾਂ ਜੀ ਜਿਸ ਤਰ੍ਹਾਂ ਕਿ ਚੌਲ ਅਤੇ ਰਾਇਤਾ ਦਾਲ ਮੱਖਣੀ ਸ਼ਾਹੀ ਪਨੀਰ ਮਿਕਸ ਸਬਜ਼ੀ ਤੰਦੂਰੀ ਰੋਟੀ ਕੀ ਤੁਸੀਂ ਇਹ ਟਾਈਮ ਸਿਰ ਪਹੁੰਚਾ ਦਉਂਗੇ ਇਹਦਾ ਉਨੱਤੀ ਤਰੀਕ ਉਨੱਤੀ ਤਰੀਕ ਨੂੰ ਗਿਆਰ੍ਹਾਂ ਵਜੇ ਅਤੇ ਸਮੇਂ ਸਿਰ ਪਹੁੰਚਾ ਦਿਓ ਅਤੇ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਪ੍ਰੋ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਾ ਹੋਵੇ ਸਾਰਾ ਕੁਛ ਸਵਾਦ ਹੋਏ ਇਸ ਤੋਂ ਇਲਾਵਾ ਹੈ ਅਤੇ ਰੈਲ ਮਾਜਰੇ ਤਰਸੇਮ ਸਿੰਘ ਦੇ ਘਰ ਮੇਨ ਰੋਡ ਪੀ ਐੱਸ ਸਰਕਾਰੀ ਬੈਂਕ ਦੇ ਨਾਲ ਹੀ ਹੈ ਸਰਵਿਸ ਰੋਡ 'ਤੇ ਉੱਥੇ ਪਹੁੰਚਾਉਣਾ ਹੈ